ਮੈਨੂੰ ਜੰਗਲਾਂ ਵਿੱਚ ਘੁੰਮਣ ਦਾ ਬਹੁਤ ਸ਼ੌਂਕ ਹੈ ਅਤੇ ਜੰਗਲੀ ਜੀਵਾਂ ਨੂੰ ਦੇਖਣ ਦਾ ਵੀ ਮੈਂ ਖੁਦ ਇੱਕ ਟਰੈਕਰ ਹਾਂ ਅਤੇ ਜੰਗਲਾਂ ਵਿੱਚ ਘੁੰਮਣ ਜਾਂਦਾ ਹਾਂ ਪਰ ਕਦੇ ਵੀ ਕਿਸੇ ਖੂੰਖਾਰ ਜੀਵ ਨਾ ਮੇਰਾ ਸਾਹਮਣਾ ਨਹੀਂ ਹੋਇਆ ਹਾਂ ਇੱਕ ਵਾਰ ਮੈਂ ਇੱਕ ਹਿਰਨ ਦੇਖਿਆ ਸੀ ਪਰ ਉਹ ਮੈਨੂੰ ਦੇਖ ਕੇ ਨੱਸ ਗਿਆ ਸੀ ਪਰ ਕਦੇ ਵੀ ਕਿਸੀ ਖੂੰਖਾਰ ਜੀਅ ਨਾ ਮੇਰਾ ਸਾਹਮਣਾ ਨਹੀਂ ਹੋਇਆ ਇੱਕ ਵਾਰੀ ਅਸੀਂ ਟਰੈਕਿੰਗ 'ਤੇ ਗਏ ਸਨ ਅਸੀਂ ਜਦੋਂ ਜੰਗਲਾਂ ਦੇ ਵਿੱਚ ਟਰੈਕਿੰਗ ਕਰ ਰਹੇ ਸੀ ਅਤੇ ਉਸ ਦੌਰਾਨ ਅਸੀਂ ਦੇਖਿਆ ਕਿ ਲੋਕਾਂ ਨੇ ਉੱਥੇ ਦਾ ਬਹੁਤ ਹੀ ਬੁਰਾ ਹਾਲ ਕਰ ਰੱਖਿਆ ਹੈ ਅਤੇ ਥਾਂ ਥਾਂ 'ਤੇ ਗੰਦਗੀ ਫੈਲਾ ਰੱਖੀ ਹੈ ਅਸੀਂ ਇਸ ਚੀਜ਼ ਨੂੰ ਆਪਣਾ ਫਰਜ਼ ਸਮਝਿਆ ਅਤੇ ਉੱਥੇ ਦੀ ਥੋੜ੍ਹੀ ਬਹੁਤੀ ਸਫਾਈ ਕੀਤੀ ਜਿੰਨਾ ਕਿ ਸਾਡੇ ਕੋਲ ਹੋ ਸਕਿਆ ਉੱਥੇ ਲੋਕਾਂ ਨੇ ਦਰਖਤਾਂ ਨੂੰ ਵੱਡਿਆ ਹੋਇਆ ਸੀ ਅਸੀਂ ਉਸ ਟਾਈਮ ਕੁਝ ਨਹੀਂ ਕਰ ਸਕੇ ਪਰ ਹਾਂ ਅਸੀਂ ਜੋ ਸਾਡੇ ਕੋਲ ਬਣ ਪਿਆ ਅਸੀਂ ਕੀਤਾ ਅਸੀਂ ਥੋੜ੍ਹੀ ਬਹੁਤੀ ਉੱਥੇ ਦੀ ਸਫਾਈ ਕੀਤੀ ਉੱਥੇ ਪਲਾਸਟਿਕ ਦੇ ਲਿਫਾਫੇ ਸੁੱਟੇ ਹੋਏ ਸਨ ਅਸੀਂ ਉਹਨਾਂ ਨੂੰ ਇਕੱਠਾ ਕੀਤਾ ਅਤੇ ਹੋਰ ਵੀ ਥੋੜ੍ਹਾ ਬਹੁਤਾ ਜੋ ਉੱਥੇ ਗੰਦ ਗਿਲਾਸ ਵਗੈਰਾ ਸੁੱਟੇ ਹੋਏ ਸਨ ਉਹ ਸਾਰੇ ਇਕੱਠੇ ਕੀਤੇ ਅਤੇ ਕੁਝ ਕੁ ਪੇੜ ਜੋ ਕਿ ਥੋੜ੍ਹੇ ਜਿਹੇ ਪਤਲੇ ਸਨ ਉਹ ਲੋਕਾਂ ਨੇ ਤੋੜ ਦਿੱਤੇ ਸਨ ਉਹਨਾਂ ਨੂੰ ਛੋਟੀ ਛੋਟੀ ਡਾਲੀਆਂ ਨੂੰ ਆਪਾਂ ਸਹੀ ਤਰੀਕੇ ਨਾਲ ਥੋੜ੍ਹਾ ਬਹੁਤਾ ਉੱਥੇ ਸੈੱਟ ਕੀਤਾ ਅਤੇ ਥੋੜ੍ਹੀ ਬਹੁਤੀ ਉਹਨਾਂ 'ਤੇ ਪਾਣੀ ਵੀ ਪਾਇਆ ਇਸ ਤਰ੍ਹਾਂ ਆਪਾਂ ਜੋ ਸਾਡੇ ਤੋਂ ਬਣ ਹੁੰਦਾ ਸੀ ਆਪਾਂ ਉੱਥੇ ਦੀ ਸਫਾਈ ਕੀਤੀ ਲੋਕਾਂ ਨੂੰ ਜੰਗਲਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉੱਥੇ ਦੀ ਪੇੜ ਪੌਦਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਖਰਾਬ ਕਰਨਾ ਚਾਹੀਦਾ ਹੈ